ਜਿੱਦਾਂ ਆਪਣੇ ਏ ਸ਼ਹਿਰਾਂ ਵਿੱਚ ਲੋਕੀ ਪਾਰਕਾਂ ਦੀ ਖੇਡਦੇ ਜਾ ਕੇ ਖੇਡ ਖੇਡਦੇ ਆ ਜਿਹਦੇ ਨਾਲ ਪਿੰਡਾਂ 'ਚ ਪਿੰਡਾਂ 'ਚ ਪਿੰਡਾਂ 'ਚ ਗਰਾਊਂਡਾਂ ਪਿੰਡਾਂ ਚ ਹੁੰਦੀਆਂ ਕੋਈ ਗ ਕ੍ਰਿਕਟ ਖੇਡਣਾ ਪਸੰਦ ਕਰਦਾ ਕੋਈ ਕਬੱਡੀ ਖੇਡਣਾ ਪਸੰਦ ਕਰਦਾ ਕੋਈ ਫੁੱਟਬਾਲ ਵਾਲੀ ਜਿਹੜੀ ਗੇਮ ਉਹ ਵਧੀਆ ਖੇਡਣਾ ਪਸੰਦ ਕਰਦਾ ਸ਼ਹਿਰਾਂ ਵਿੱਚ ਛੋਟੀਆਂ ਪਾਰਕਾਂ ਵਿੱਚ ਕੋਈ ਕਿਆ ਖੇਡਦੇ ਆ ਕੀ ਆ ਹੀ ਖੇਡਦੇ ਮਾੜਾ ਮੋਟਾ ਛੋਟੀ ਛੋਟੀ ਪਾਰਕ ਹੁੰਦੀਆਂ ਉਹਦੇ ਵਿੱਚ ਕ੍ਰਿਕਟ ਖੇਡ ਲਈ ਆ ਉਹਨਾਂ ਨੇ ਜਾਂ ਫਿਰ ਆਪਣੇ ਖੋ ਖੋ ਖੋ ਖੂ ਖੇਡ ਲੈਂਦੇ ਆ ਹੋਰ ਕੀ ਖੇਡਣਾ ਛੋਟੀਆਂ ਗਰਾਊਂਡ ਛੋਟੀਆਂ ਪਾਰਕ ਹੁੰਦੀਆਂ ਸ਼ਹਿਰਾਂ 'ਚ ਪਿੰਡਾਂ ਵਿੱਚ ਬੜੇ ਬੜੇ ਗਰਾਉਂਡਾਂ ਹੁੰਦੀਆਂ ਕੋਈ ਆਪਣੀ ਮਨ ਪਸੰਦ ਗੇਮ ਖੇਡਦਾ ਕੋਈ ਖੇਡਦਾ ਕਬੱਡੀ ਖੇਡਦਾ ਕੋਈ ਫੁਟਬਾਲ ਖੇਡਦਾ ਕੋਈ ਕ੍ਰਿਕਟ ਖੇਡਦਾ ਆਪਣੀ ਆਪਣੀ ਪਸੰਦ ਦੀ ਖੇਡ ਗੇਮਾਂ ਖੇਡਦੇ ਆ ਸਾਰਿਆਂ ਨੂੰ ਆਪਣੀ ਪਸੰਦ ਦੀ ਗੇਮ ਵਧੀਆ ਲੱਗਦੀ ਆ